ਮੈਂ ਆਪਣੇ ਜੀਵਨ ਦੇ ਹੋਰ ਕੰਮਾਂ ਨਾਲ ਹੋਰ ਕੰਮਾਂ ਨਾਲ ਜਾਂ ਕੋਲਜ ਨਾਲ ਗਾਉਣਾ ਸਟਾਰਟ ਕਰਦੀ ਹਾਂ ਜਦੋਂ ਮੈਂ ਕੋਈ ਵੀ ਕੰਮ ਕਰਕੇ ਫਰੀ ਹੋਵਾਂ ਕੋਈ ਵੀ

ਗਾਇਕੀ ਸਟਾਰਟ ਕਰ ਦਿੰਦੀ ਹਾਂ ਅਤੇ ਮੇਰਾ ਨਾਲ ਨਾਲ ਗਾਉਣ ਦਾ ਵੀ ਵਧੀਆ ਤਰੀਕਾ ਬਣਿਆ ਰਹਿੰਦਾ ਹੈ ਅਤੇ ਮੇਰੇ ਬਾਕੀ ਕੰਮ ਵੀ ਗਾਉਣ ਦੇ ਨਾਲ ਨਾਲ ਵਧੀਆ ਹੋ ਜਾਂਦੇ ਹਨ ਅਤੇ ਮੇਰੀ ਪੜ੍ਹਾਈ ਵੀ ਵਧੀਆ ਮੈਨੇਜ ਹੋ ਜਾਂਦੀ ਹੈ